ਮੇਰੇ ਲਈ ਭੰਗੜਾ ਅਤੇ ਐਰੋਬਿਕਸ ਦੋਵੇਂ ਹੀ ਬਹੁਤ ਵਧੀਆ ਤਜ਼ਰਬਾ ਰਹੇ ਹਨ ਕਿਉਂਕਿ ਇਹ ਦੋਵੇਂ ਸਾਡੀ ਐਨਰਜੀ ਫਿਟਨਸ ਅਤੇ ਸਟੈਮਿਨਾ ਨੂੰ ਬਿਹਤਰ ਬਣਾਉਂਦੇ ਹਨ ਭੰਗੜਾ ਇੱਕ ਪੂਰਾ ਸਰੀਰ ਵਰਕ ਆਊਟ ਹੈ ਜਿਸ ਵਿੱਚ ਲੱਗੇ ਛਾਲਾ ਜਾਂ ਹਤੇ ਹੱਥਾਂ ਦੀ ਹਰਕਤ ਆਉਂਦੀ ਹੈ ਇਹ ਸਿਰਫ਼ ਇੱਕ ਨੱਚਣ ਦੀ ਸ਼ੈਲੀ ਨਹੀਂ ਬਲਕਿ ਮਨੋਰੰਜਨ ਅਤੇ ਵਿਆਮ ਦੋਵੇਂ ਲਈ ਵਧੀਆ ਹੈ ਦੂਜੇ ਪਾਸੇ ਐਰੋਬਿਕਸ ਦੀ ਕਾਰਡੀਓ ਵਰਕਔਟ ਲਈ ਬਹੁਤ ਫ਼ਾਇਦੇਮੰਦ ਹੈ ਜਿਵੇਂ ਜੰਪਿੰਗ ਜੈਕਸ ਹਾਈ ਨੀਸ ਅਤੇ ਲੰਗਜ ਜੋ ਦਿਲ ਦੀ ਬਿਮਾਰੀ ਅਤੇ ਕੈਲੋਰੀ ਵਰਨ ਵਿੱਚ ਮਦਦ ਕਰਦੇ ਹਨ ਜਦੋਂ ਮੈਂ ਭੰਗੜੇ ਅਤੇ ਐਰੋਬਿਕਸ ਨੂੰ ਮਿਲਾ ਕੇ ਵਰਕਆਊਟ ਕਰਦਾ ਹਾਂ ਤਾਂ ਇਹ ਹੋਰ ਵੀ ਮਜ਼ੇਦਾਰ ਆ ਅਤੇ ਉਤਸਾਹ ਭਰਪੂਰ ਹੋ ਜਾਂਦਾ ਹੈ ਭੰਗੜਾ ਐਰੋਬਿਕਸ ਵਿੱਚ ਧਮਾਲ ਜੰਪਿੰਗ ਜੈਕਸ ਝੂਮਰ ਹਾਈ ਨੀਜ ਵਰਗੇ ਸਟੈੱਪ ਸ਼ਾਮਲ ਕਰਕੇ ਮੈਂ ਆਪਣੀ ਫਿਟਨੈਸ ਨੂੰ ਵਧੀਆ ਬਣਾਉਂਦਾ ਹਾਂ ਇਹ ਤਰੀਕਾ ਦਿਲ ਦੀ ਧੜਕਣ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮਨ ਨੂੰ ਵੀ ਤੰਦਰੁਸਤ ਰੱਖਦਾ ਹੈ ਇਸ ਤਰੀਕੇ ਨਾਲ ਭੰਗੜਾ ਅਤੇ ਐਰੋਬਿਕਸ ਸਾਡੇ ਸਰੀਰ ਅਤੇ ਦਿਮਾਗ ਦੋਵਾਂ ਲਈ ਇੱਕ ਬਹੁਤ ਵਧੀਆ ਸੰਯੋਗ ਹਨ ਭੰਗੜਾ ਅਤੇ ਐਰੋਬਿਕਸ ਦੋਵਾਂ ਦੀ ਸਿਰਫ਼ ਸਰੀਰਿਕ ਕਸਰਤ ਨਹੀਂ ਬਲਕਿ ਮਨ ਦੀ ਖੁਸ਼ਹਾਲੀ ਅਤੇ ਉਤਸ਼ਾਹ ਵਧਾਉਣ ਦੇ ਵਧੀਆ ਤਰੀਕੇ ਵੀ ਹਨ ਜਦੋਂ ਮੈਂ ਭੰਗੜੇ ਦੀ ਰਿਧਮ ਅਤੇ ਐਰੋਬਿਕਸ ਦੀ ਸਪੀਡ ਨੂੰ ਮਿਲਾ ਕੇ ਵਰਕਆਊਟ ਕਰਦਾ ਤਾਂ ਇਹ ਇੱਕ ਮਜ਼ੇਦਾਰ ਉਤਸਾਹ ਪੂਰਨ ਅਤੇ ਇਫੈਕਟਿਵ ਵਰਕਆਊਟ ਬਣ ਜਾਂਦਾ ਹੈ